ਅਸੀਂ ਭਾਰਤ ਦੇ ਪੰਜਾਬ 'ਚ ਸਟੇਟ ਵਿੱਚ ਰਹਿੰਦੇ ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਪੰਜਾਬ ਜੇ ਹੋ ਗਿਆ ਆਪਣਾ ਭਾਰਤ ਹੋ ਗਿਆ ਇਹ 'ਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਅਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਸ ਸਾਡੇ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਪਾਏ ਜਾਂਦੇ ਹਿੰਦੂ ਸਿੱਖ ਈਸਾਈ ਸਾਰੇ ਭਰਾ ਵਾਂਗੂ ਰਹਿੰਦੇ ਹਨ ਅਤੇ ਇੱਥੇ ਸਾਡੇ ਅਸੀਂ ਖਾਸ ਕਰ ਪਟਿਆਲੇ ਦੇ ਵਿੱਚ ਇਹ ਤਾਂ ਹੈ ਨੀਗਾ ਕੋਈ ਕੋਈ ਜਾਤ ਦੇ ਭਾਈਚਾਰਾ ਰਹਿੰਦੇ ਹਨ ਇੱਥੇ ਹਿੰਦੂ ਵੀ ਨੇ ਇੱਥੇ ਸਿੱਖ ਵੀ ਨੇ ਅਤੇ ਸਾਰੇ ਬੜੇ ਹੀ ਪਿਆਰ ਪਿਆਰ ਨਾਲ ਰਹਿੰਦੇ ਹਨ ਅਤੇ ਕਿਸੇ ਨਾਲ ਕੋਈ ਭਾਵਨਾ ਨਹੀਂ ਹੈ ਜੇ ਮੰਨ ਲਓ ਕਦੇ ਕੋਈ ਸਿੱਖਾਂ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਸਾਰੇ ਹਿੰਦੂ ਵੀਰ ਜਾਂ ਹੋਰ ਧਰਮਾਂ ਦੇ ਲੋਕ ਵੱਧ ਚੜ ਕੇ ਉੱਥੇ ਪਹੁੰਚਦੇ ਹਨ ਅਤੇ ਲੰਗਰ 'ਚ ਸੇਵਾ ਕਰਦੇ ਹਨ ਅਤੇ ਉਹਨਾਂ ਦੇ ਜਿਵੇਂ ਰੀਤੀ ਰਿਵਾਜ਼ ਹੁੰਦੇ ਆ ਉਹ 'ਚ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ ਉਵੇਂ ਉਸੇ ਤਰ੍ਹਾਂ ਇੱਕ ਦੂਜੇ ਦੀ ਮਦਦ ਕਰਦੇ ਹਨ ਉਹ ਅਤੇ ਉਸੇ ਤਰ੍ਹਾਂ ਜਦੋਂ ਕਿਸੇ ਦਾ ਮੰਨ ਲਓ ਆਪਣਾ ਹਿੰਦੂਆਂ ਦਾ ਧਰਮ ਹੁੰਦਾ ਹੈ ਤਾਂ ਉਹਦੇ 'ਚ ਵੀ ਸਿੱਖ ਭਾਈਚਾਰਾ ਮੁਸਲਿਮ ਭਾਈਚਾਰਾ ਆਪਸ ਦੇ ਵਿੱਚ ਰਲ ਮਿਲ ਕੇ ਇਕੱਠੇ ਇੱਕ ਦੂਜੇ ਦੇ ਸਾਂਝ 'ਚ ਜਾਂਦੇ ਹਨ ਇਸੇ ਤਰ੍ਹਾਂ ਜਿਵੇਂ ਆਪਣਾ ਭੋਗਾਂ ਦੇ ਵਿੱਚ ਹੋ ਗਿਆ ਅਤੇ ਆਪਣੇ ਅਖੰਡ ਪਾਠਾਂ 'ਚ ਹੋ ਗਿਆ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਜਾਂਦੇ ਹਨ ਭਾਈਚਾਰਾ ਅਤੇ ਅਤੇ ਇਸ ਇਹ ਮੈਨੂੰ ਚੀਜ਼ ਵੀ ਬਹੁਤ ਵਧੀਆ ਲੱਗਦੀ ਹੈ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਇੱਕ ਦੇਸ਼ ਦੇ ਹੋਣ ਅਤੇ ਇੱਕ ਹੀ ਧਰਮ ਹੋਵੇ ਕਿ ਸਾਰੇ ਧਰਮਾਂ 'ਚ ਜਿਵੇਂ ਆਪਣੇ ਫੁੱਲਾਂ ਵਾਂਗੂ ਫੁੱਲਾਂ ਦੇ ਵਿਚ ਹਰ ਇੱਕ ਤਰ੍ਹਾਂ ਦੇ ਫੁੱਲ ਹੁੰਦੇ ਨੇ ਬਾਗ ਬਾਗਾਂ ਦੀ ਵਿੱਚ ਕਮਲ ਦੇ ਫੁੱਲ ਗੁਲਾਬ ਦੇ ਫੁੱਲ ਜੇ ਆਪਾਂ ਸੋਚ ਲਈਏ ਕਿ ਇੱਕ ਹੀ ਤਰ੍ਹਾਂ ਦਾ ਫੁੱਲ ਹੋਵੇ ਉਹ ਉਹ ਜਿਹੜਾ ਹੁੰਦਾ ਬਾਗ ਸੋਹਣਾ ਨਹੀਂ ਲੱਗਦਾ ਇਸ ਲਈ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਹੀ ਹੀ ਰਹਿਣ ਤਾਂ ਚੰਗੀ ਗੱਲ ਆ ਅਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ ਜਾਂਦੇ ਹਾਂ ਕੋਈ ਕਿਸੇ ਬਾਰੇ ਵਿਤਕਰਾ ਨਹੀਂ ਕਰਦਾ ਕਿ ਆਹ ਦੂਸਰੇ ਦਾ ਆਪਸ 'ਚ ਹੀ ਪਿਆਰ ਹੋਣਾ ਚਾਹੀਦਾ ਭਾਈਚਾਰਾ ਅਹਿਮ ਹੋਣਾ ਚਾਹੀਦਾ ਧਰਮ ਬਾਅਦ ਵਿੱਚ ਪਹਿਲਾਂ ਭਾਈਚਾਰਾ ਅਤੇ ਮੁਹੱਬਤ ਹੋਣਾ ਚਾਹੀਦਾ ਇਹ ਹੀ ਮੈਨੂੰ ਦੇਖਣ ਨੂੰ ਮਿਲਿਆ ਪਹਿਲੇ ਦਿਨ ਤੋਂ ਹੀ ਬਚਪਨ 'ਚ ਵੀ ਮਾਤਾ ਪਿਤਾ ਨੇ ਸਿਖਾਇਆ ਸੀ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਸਾਰੇ ਧਰਮ ਬਰਾਬਰ ਨੇ ਹਾਂ ਜਿਹੜੇ ਧਰਮ ਵਿੱਚ ਪਰਮਾਤਮਾ ਨੇ ਜਨਮ ਦਿੱਤਾ ਆਪਾਂ ਨੂੰ ਉਹਦੀ ਪਾਲਣਾ ਜ਼ਰੂਰ ਕਰੋ ਪਰ ਹਰ ਇੱਕ ਭਾਈਚਾਰੇ ਨਾਲ ਸਾਂਝ ਪਿਆਰ ਮੁਹੱਬਤ ਬਣਾ ਕੇ ਰੱਖਣੀ ਚਾਹੀਦੀ